ਮੇਰੇ ਇਲਾਕੇ ਵਿੱਚ ਬਹੁਤ ਸਾਰੀਆਂ ਘੁੰਮਣ ਵਾਸਤੇ ਥਾਵਾਂ ਹਨ ਅਸੀਂ ਚੰਡੀਗੜ੍ਹ ਸੁਖਨਾ ਲੇਕ ਅਤੇ ਰੌਕ ਗਾਰਡਨ ਵਿੱਚ ਘੁੰਮਣ ਲਈ ਜਾਂਦੇ ਰਹਿੰਦੇ ਹਾਂ ਸੁਖਨਾ ਲੇਕ ਵਿੱਚ ਬਹੁਤ ਸਾਰੇ ਲੋਕ ਉੱਥੇ ਦਾ ਦ੍ਰਿਸ਼ ਦੇਖਣ ਲਈ ਪਹੁੰਚਦੇ ਹਨ ਸੁਖਨਾ ਲੇਕ ਵਿੱਚ ਖਾਣ ਪੀਣ ਦਾ ਵੀ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਜਿਸ ਨੂੰ ਲੋਕ ਬਹੁਤ ਸਾਰਾ ਇੰਜੋਆਏ ਕਰਦੇ ਹਨ ਅਤੇ ਫਿਰ ਘਰਾਂ ਨੂੰ ਜਾਂਦੇ ਹਨ ਰੌਕ ਗਾਰਡਨ ਵਿੱਚ ਬਹੁਤ ਸਾਰੀਆਂ ਬਹੁਤ ਸਾਰੇ ਲੋਕ ਆਉਂਦੇ ਹਨ ਉੱਥੇ ਵੇਸਟ ਮੈਟੀਰੀਅਲ ਨਾਲ ਬਹੁਤ ਚੰਗੀਆਂ ਚੰਗੀਆਂ ਮੂਰਤੀਆਂ ਬਣਾਈਆਂ ਗਈਆਂ ਹਨ ਸਾਡੇ ਮੋਹਾਲੀ ਚੰਡੀਗੜ੍ਹ ਦੇ ਨੇੜਲੇ ਇਲਾਕੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵੀ ਹੈ ਅਤੇ ਅੰਬ ਸਾਹਿਬ ਗੁਰਦੁਆਰਾ ਵੀ ਹੈ ਉੱਥੇ ਬਹੁਤ ਸਾਰੀਆਂ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ ਹਨ ਮੈਂ ਆਪਣਾ ਵਿਹਲਾ ਸਮਾਂ ਗੁਰਦੁਆਰੇ ਵਿੱਚ ਨਤਮਸਤਕ ਹੋਣ ਲਈ ਲਗਾਉਂਦਾ ਹਾਂ ਮੈਨੂੰ ਗੁਰਦੁਆਰੇ ਵਿੱਚ ਘੁੰਮਣ ਮੈਂ ਉੱਥੇ ਪਾਠ ਕਰਦਾ ਹਾਂ ਮੈਂ ਉੱਥੇ ਬਹੁਤ ਸਾਰੀ ਸੇਵਾ ਕਰਕੇ ਫਿਰ ਘਰ ਆਉਂਦਾ ਹਾਂ